ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਪ੍ਰਿਆ ਮੈਮ ਮੈਂ ਤੁਹਾਨੂੰ ਪੁੱਛਣਾ ਸੀ ਮੈਂ ਐਕਚੁਲੀ ਜੰਮੂ ਤੋਂ ਪਠਾਨਕੋਟ ਆਈ ਹਾਂ ਇੱਥੇ ਘੁੰਮਣ ਫਿਰਨ ਲਈ ਮੈਂ ਇੱਥੇ ਹਿਸਟੋਰੀਕਲ ਗੁਰਦੁਆਰੇ ਬਾਰੇ ਪੁੱਛਣਾ ਸੀ ਕਿ ਇੱਥੇ ਕੋਈ ਫੇਮਸ ਹਿਸਟੋਰੀਕਲ ਗੁਰਦੁਆਰਾ ਹੈਗਾ ਓਕੇ ਮੈਮ ਅਤੇ ਮੈਮ ਇੱਥੇ ਲੰਗਰ ਵਗੈਰਾ ਦਾ ਹੈਗਾ ਪ੍ਰਬੰਧ ਅੱਛਾ ਅੱਛਾ ਤਾਂ ਮੈਮ ਇਹਦੀ ਲੋਕੇਸ਼ਨ ਕੀ ਹੋਏਗੀ ਕਿਸ ਦੇ ਨੇੜੇ ਮੈਮ ਸੁਜ਼ਾਨਪੁਰ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਓਕੇ ਮੈਮ